ਭੰਗੜਾ ਭਾਰਤੀ ਉਪ ਮਹਾਦੀਪ ਦੇ ਪੰਜਾਬ ਖੇਤਰ ਦਾ ਇੱਕ ਰਿਵਾਇਤੀ ਲੋਕ ਨਾਚ ਹੈ ਮੈਨੂਅਲ ਦੇ ਅਨੁਸਾਰ ਭੰਗੜਾ ਖਾਸ ਤੌਰ 'ਤੇ ਵਿਸਾਖੀ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ ਜੋ ਅਪ੍ਰੈਲ ਅਤੇ ਮਈ ਦੀ ਪਹਿਲੀ ਤਿਮਾਹੀ ਦੇ ਵਿੱਚ ਆ ਵਿਚਕਾਰ ਵਾਢੀ ਦੇ ਮੌਸਮ ਦੌਰਾਨ ਕੀਤਾ ਜਾਂਦਾ ਹੈ ਇੱਕ ਆਮ ਪ੍ਰਦਰਸ਼ਨ ਵਿੱਚ ਕਈ ਨ੍ਰਿਤਕ ਜ਼ੋਰਦਾਰ ਲੱਤਾਂ ਛਾਲਾਂ ਅਤੇ ਸਰੀਰ ਦੇ ਮੋੜਾਂ ਨੂੰ ਚਲਾਉਂਦੇ ਹਨ ਅਕਸਰ ਉੱਪਰ ਉੱਠੇ ਹੋਏ ਜ਼ੋਰਦਾਰ ਬਾਹਾਂ ਜਾਂ ਮੋਢੇ ਦੀਆਂ ਹਰਕਤਾਂ ਨਾਲ ਬੋਲੀਆਂ ਨਾਮਕ ਛੋਟੇ ਗੀਤਾਂ ਦੇ ਨਾਲ ਅਤੇ ਸਭ ਤੋਂ ਮਹੱਤਵਪੂਰਨ ਢੋਲ ਦੀ ਤਾਲ 'ਤੇ ਇੱਕ ਸਿਰੇ 'ਤੇ ਭਾਰੀ ਬਿਟਰ ਨਾਲ ਦੂਜੇ ਸਿਰੇ 'ਤੇ ਹਲਕੀ ਸੋਟੀ ਨਾਲ ਢੋਲ ਸੰਗੀਤ ਨੂੰ ਇੱਕ ਕਮਜ਼ੋਰ ਬੀਟਾਂ ਦੇ ਲਹਿਜੇ ਝੂਲਦੇ ਤਾਲਬ ਪਾਤਰ ਨਾਲ ਰੰਗਦਾ ਹੈ ਜੋ ਆਮ ਤੌਰ 'ਤੇ ਭੰਗੜਾ ਸੰਗੀਤ ਦੀ ਪਹਿਚਾਣ ਕਰਵਾਉਂਦਾ ਹੈ ਅੱਜ ਸਾਡੇ ਨੌਜਵਾਨ ਭੰਗੜਾ ਐਰੋਬਿਕਸ ਵਿੱਚ ਜ਼ਿਆਦਾ ਧਿਆਨ ਵੀ ਦਿੰਦੇ ਨੇ ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਭੰਗੜੇ ਨੂੰ ਅਲੱਗ ਅਲੱਗ ਰੂਪਾਂ ਵਿੱਚ ਪੇਸ਼ ਕਰਦੇ ਹਨ ਅਤੇ ਵੱਧ ਤੋਂ ਵੱਧ ਇਸ ਵਿੱਚ ਹਿੱਸਾ ਲੈਂਦੇ ਹਨ ਇਹ ਸਾਡੇ ਸਰੀਰ ਲਈ ਵੀ ਵਧੀਆ ਹੁੰਦਾ ਹੈ ਇਹ ਸਰੀਰ ਨੂੰ ਬਿਲਕੁਲ ਮਜ਼ਬੂਤ ਬਣਾ ਕੇ ਰੱਖਦਾ ਹੈ ਇੱਕ ਕੋ ਇੱਕ ਤੁਹਾਡੀ ਇਹੀ ਕਹਿ ਸਕਦੇ ਹਾਂ ਆਪਾਂ ਕਿ ਸਭ ਕੁਛ ਭੰਗੜੇ ਨਾਲ ਸੈਟ ਹੋ ਜਾਂਦਾ ਹੈ ਸਰੀਰ ਤੁਹਾਡਾ ਠੀਕ ਹੋ ਜਾਂਦਾ ਹੈ ਭੰਗੜਾ ਐਰੋਬਿਕਸ ਆਉਣ ਵਾਲੇ ਟਾਈਮ ਸਮੇਂ ਵਿੱਚ ਪ੍ਰਸਿੱਧ ਹੋਵੇਗਾ ਕਿਉਂਕਿ ਇਸ ਨਾਲ ਅੱਜ ਦੇ ਨੌਜਵਾਨ ਕਾਫੀ ਜੁੜੇ ਹੋਏ ਨੇ ਇਸ ਕਰਕੇ ਭੰਗੜਾ ਐਰੋਬਿਕਸ ਭਵਿੱਖ ਵਿੱਚ ਜ਼ਰੂਰ ਪ੍ਰਸਿੱਧ ਹੋਵੇਗਾ